ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਸਥਾਨਕ ਭਾਈਚਾਰੇ ਨੂੰ ਸਮਰਥਨ ਅਤੇ ਸ਼ਾਮਿਲ ਕਰਦੇ ਹਾਂ ਕਈ ਤਰੀਕੇ ਨਾਲ ਜਿਵੇਂ ਕਿ ਸਹਿਕਾਰੀ ਰਾਹੀਂ ਦੁਨਿਆਵੀ ਦਰਜ਼ ਦੀ ਸ਼ੋਹਰਤ ਪਰਿਵਰਤਨ ਐਨ ਜੀ ਓ 'ਤੇ ਪਰਿਵਰਤਨ ਇਹ ਸਭ ਕੁਛ ਇੱਕ ਲੋਕ ਔਰ ਸੰਗਠਨ ਦੀ ਮਦਦ ਨਾਲ ਹੋ ਸਕਦਾ ਹੈ ਸਹਿਕਾਰੀ ਰਾਹੀਂ ਸਹਿਕਾਰੀ ਸਿਸਟਮ ਪੰਜਾਬ ਦੀ ਕਲਾ ਅਤੇ ਦੀ ਸ਼ਿਲਪਕਾਰੀ ਸਥਾਨਕ ਭਾਈਚਾਰੇ ਨੂੰ ਵੱਧ ਤੋਂ ਵੱਧ ਸਮਰਥਨ 'ਤੇ ਸ਼ਾਮਿਲ ਕਰ ਸਕਦਾ ਹੈ ਇਹ ਸਿਸਟਮ ਇੱਕ ਤਰ੍ਹਾਂ ਦੇ ਏਕਤਾ ਦੀ ਭਾਵਨਾ ਨੂੰ ਪੇਸ਼ ਕਰਦਾ ਹੈ ਜਿੱਥੇ ਕਲਾ ਦੇ ਹੁਨਰ ਦੇ ਇਹ ਮੁੱਲ ਪੂਜਿਆ ਜਾਂਦਾ ਹੈ ਲੋਕਾਂ ਨੇ ਆਪਣੇ ਆਪਣੇ ਕਲਾ ਬੁਨਿਆਦ ਬਣਾਈ ਜਾਂਦੀ ਹੈ ਤੇ ਉਹਨਾਂ ਦੀ ਮਦਦ ਨਾਲ ਸਥਾਨਕ ਭਾਈਚਾਰੇ ਦੀ ਭਾਵਨਾ ਅਤੇ ਵਧਾਈ ਹੈ ਦੂਸਰਾ ਦੁਨਿਆਵੀ ਦਰਜ਼ ਦੀ ਸ਼ੋਹਰਤ ਪੰਜਾਬ ਦੀ ਕਲਾ ਅਤੇ ਤੀਹ ਸ਼ਿਲਪਕਾਰੀ ਸਥਾਨਕ ਭਾਈਚਾਰੇ ਨੂੰ ਦੁਨਿਆਵੀ ਦਰਜ਼ ਦੀ ਸ਼ੋਹਰਤ 'ਤੇ ਸਮਰਥਨ ਮਿਲ ਸਕਦਾ ਹੈ ਜਿਵੇਂ ਕਿ ਵਧੀਆ ਕੰਮ ਕਰਕੇ ਇੰਟਰਨੈਸ਼ਨਲ ਦਰਜ਼ ਦੀ ਸ਼ੋਹਰਤ ਹਾਸਲ ਕਰਨਾ ਜਦੋਂ ਲੋਕ ਦੁਨਿਆਵੀ ਸਤਾਰ ਅਤੇ ਸ਼ੋਹਰਤ ਹਾਸਲ ਕਰਦੇ ਨੇ ਤਾਂ ਉਹਨਾਂ ਦੀ ਕਮੀਆਂ ਅਤੇ ਪੰਜਾਬ ਦੀ ਕਲਾ ਅਥਾਹ ਦੀ ਸ਼ਿਲਪਕਾਰੀ ਦਾ ਪ੍ਰਚਾਰ ਵਧਾਉਂਦਾ ਹੈ ਅਤੇ ਲੋਕ ਸਮਝਦੇ ਹਨ ਕਿ ਉਹਨਾਂ ਦੀਆਂ ਕਲਾਵਾਂ ਨੂੰ ਸਨਮਾਨ ਦੀ ਜ਼ਰੂਰਤ ਹੈ